ਲੋਕ ਇਸ ਧਰਮ ਵਿੱਚ ਆਪਣਾ ਵਿਸ਼ਵਾਸ ਪ੍ਰਗਟ ਕਰਦੇ ਹਨ ਕਿ ਲੋਕਾਂ ਨੂੰ ਜਿਹੜਾ ਸਿੱਖੀ ਦਾ ਧਰਮ ਹੈ ਸਿੱਖ ਧਰਮ ਹੈ ਇਹ ਬਹੁਤ ਹੀ ਨਿੱਘਾ ਪਿਆਰਾ ਧਰਮ ਹੈ ਜਿਹਦੇ ਵਿੱਚ ਕੋਈ ਸਾਨੂੰ ਬੰਦਿਸ਼ਾਂ ਨਹੀਂ ਹੈ ਜ਼ਿਆਦਾ ਅਸੀਂ ਕੋਈ ਵੀ ਧਰਮ ਦਾ ਜਿਹੜਾ ਬੰਦਾ ਹੈ ਉਹ ਇਸ ਧਰਮ ਨੂੰ ਆ ਕੇ ਅਪਣਾ ਸਕਦਾ ਹੈ ਇਸ ਧਰਮ ਦੀਆਂ ਗੱਲਾਂ ਮੰਨ ਸਕਦਾ ਹੈ ਸਾਡੇ ਜਿਹੜੇ ਗੁਰੂਆਂ ਨੇ ਆਪਣੀਆਂ ਕੁਰਬਾਨੀਆਂ ਦੇ ਕੇ ਧਰਮ ਨੂੰ ਚਲਾਇਆ ਹੈ ਔਰ ਇਸ ਧਰਮ ਦੇ ਬਾਰੇ ਬਾਕੀ ਲੋਕਾਂ ਦੇ ਵੀ ਇਹੀ ਹੈ ਰਾਏ ਕਿ ਅਸੀਂ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਨਤਮਸਤਕ ਹੁੰਦੇ ਹਾਂ ਅਤੇ ਸਾਡੀਆਂ ਕਈ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਨੇ ਸਾਡੇ ਮਨ ਨੂੰ ਸ਼ਾਂਤੀ ਮਿਲਦੀ ਹੈ ਔਰ ਕਈ ਉਹਨਾਂ ਦੇ ਕਾਰਜ ਜਿਹੜੇ ਰੁਕੇ ਹੈ ਉਹ ਸਾਰੇ ਪੂਰੇ ਹੁੰਦੇ ਹਨ ਜਿਹਦੇ ਕਰਕੇ ਇਸ ਧਰਮ ਦੇ ਵਿੱਚ ਸਾਡਾ ਅਤੇ ਸਭ ਦਾ ਵਿਸ਼ਵਾਸ ਪੂਰਾ ਹੋ ਰਿਹਾ ਹੈ